ਹਰ ਇੱਕ ਖਿੱਤੇ ਦੀ ਆਪਣੀ ਆਪਣੀ ਭਾਸ਼ਾ ਹੁੰਦੀ ਹੈ ਜਿਵੇਂ ਮਾਝੇ ਦੀ ਆਪਣੀ ਆ ਮਾਲਵੇ ਦੀ ਆਪਣੀ ਆ ਦੁਆਬੇ ਦੀ ਆਪਣੀ ਆ ਪਰ ਅਸੀਂ ਫਤਿਹਗੜ੍ਹ ਸਾਹਿਬ ਇੱਧਰ ਜਿੱਥੇ ਅਸੀਂ ਰਹਿੰਦੇ ਹਾਂ ਇੱਥੇ ਸਭ ਰਲਮੀ ਮਿਲਮੀ ਭਾਸ਼ਾ ਮੇਨ ਭਾਸ਼ਾ ਸਾਡੀ ਜਿਹੜੀ ਪੰਜਾਬ ਦੀ ਪੰਜਾਬੀ ਹੈ ਅਤੇ ਸਾਰੇ ਇੱਥੇ ਇਹ ਪੰਜਾਬੀ ਹੀ ਬੋਲਦੇ ਹਨ ਪਰ ਹੁਣ ਅੱਜ ਦੇ ਜ਼ਮਾਨੇ ਦੇ ਵਿੱਚ ਜਿਵੇਂ ਨਵੀਂ ਜਨਰੇਸ਼ਨ ਆ ਨਵੇਂ ਨੌਜਵਾਨ ਆ ਰਹੇ ਨੇ ਜਾਂ ਬੱਚੇ ਆ ਉਹ ਅੰਗਰੇਜ਼ੀ ਨੂੰ ਬਹੁਤ ਜ਼ਿਆਦਾ ਅਹਿਮੀਅਤ ਦੇ ਰਹੇ ਨੇ ਕਿਉਂਕਿ ਅੰਗਰੇਜ਼ੀ ਆ ਇੰਗਲਿਸ਼ ਆ ਜੋ ਅੰਤਰਰਾਸ਼ਟਰੀ ਪੱਧਰ ਦੀ ਭਾਸ਼ਾ ਹੈ ਇਸ ਕਰਕੇ ਬੱਚਿਆਂ ਦਾ ਰੁਝਾਨ ਬਾਹਰ ਜ ਵੱਲ ਹੋਣ ਕਰਕੇ ਉਹ ਅੰਗਰੇਜ਼ੀ ਨੂੰ ਬਹੁਤ ਜ਼ਿਆਦਾ ਮਹੱਤਤਾ ਦਿੰਦੇ ਹਨ ਪਰ ਜਾਣੀ ਕਿ ਆਮ ਲੋਕਾਂ ਦੇ ਵਿੱਚ ਜੋ ਤੁਸੀਂ ਆਮ ਘਰਾਂ ਦੇ ਵਿੱਚ ਜਾਂ ਕਿਤੇ ਵਿਆਹਾਂ ਸ਼ਾਦੀਆਂ 'ਤੇ ਜਾਂ ਕਿਤੇ ਇਕੱਠ ਵਿੱਚ ਗੱਲ ਕਰਨੀ ਆ ਉੱਥੇ ਪੰਜਾਬੀ ਹੀ ਵਿੱਚ ਹੀ ਗੱਲ ਹੁੰਦੀ ਆ ਅਤੇ ਅਸੀਂ ਪੰਜਾਬੀ ਨੂੰ ਹੀ ਜ਼ਿਆਦਾ ਮਾਨਤਾ ਦਿੰਦੇ ਹਾਂ